ਪੰਜਾਬੀ ਭਾਸ਼ਾ ਨੂੰ ਅਸੀਂ ਮਤਲਬ ਅੱਗੇ ਕਿਵੇਂ ਲਿਜਾ ਸਕਦੇ ਹਾਂ ਇਸਦਾ ਸਭ ਤੋਂ ਬੈਸਟ ਵੇਅ ਜੋ ਹੈ ਆਪਣੇ ਬੱਚਿਆਂ ਨੂੰ ਘਰ 'ਚ ਪੰਜਾਬੀ ਬੋਲੋ ਅਤੇ ਔਰ ਸੁਬਹ ਸ਼ਾਮ ਉਹਨਾਂ ਨੂੰ ਗੁਰਦੁਆਰੇ ਲੈ ਕੇ ਜਾਉ ਆਪਣੇ ਨਾਲ ਪਾਠ ਕਰੋ ਉਹਨਾਂ ਨੂੰ ਪ ਇੰਟਰਸਟ ਦਿਖਾਏ ਕਿ ਅਸੀਂ ਵੀ ਪਾਠ ਕਰਨਾ ਅਸੀਂ ਗੁਰਦੁਆਰੇ ਜਾਣਾ ਕਿਉਂਕਿ ਇਸ ਤੋਂ ਬੈਸਟ ਹੋਰ ਪੰਜਾਬੀ ਨੂੰ ਅੱਗੇ ਵਧਾਉਣ ਦਾ ਸਭ ਤੋਂ ਫਸਟ ਪੁਆਇੰਟ ਇਹ ਹੈ ਘਰ ਤੋਂ ਉਸ ਤੋਂ ਇਲਾਵਾ ਅਸੀਂ ਸਕੂਲ 'ਚ ਵੀ ਮਤਲਬ ਇਹ ਨਾ ਦੇਖੋ ਕਿ ਸਿਰਫ ਜਿੱਥੇ ਇੰਗਲਿਸ਼ ਹੀ ਹੈ ਸਭ ਕੁਛ ਇੰਗਲਿਸ਼ ਮਤਲਬ ਮੀਡੀਅਮ ਹੈ ਪੰਜਾਬੀ ਬਿਲਕੁਲ ਹੀ ਨਹੀਂ ਉੱਥੇ ਪਾਉਣਾ ਪੰ ਮਤਲਬ ਪੰਜਾਬੀ ਕੰਪਲਸਰੀ ਹੋਣੀ ਚਾਹੀਦੀ ਹੈ ਫਸਟ ਕਲਾਸ ਤੋਂ ਹਰ ਸਕੂਲ 'ਚ ਚਾਹੇ ਉਹ ਕ੍ਰਿਸਚਨ ਹੈ ਕੋਈ ਜਿਹੜਾ ਮਰਜ਼ੀ ਸਕੂਲ ਹੋਏ ਔਰ ਅਪ ਆਪਣੇ ਹਿਸਟਰੀ ਜੋ ਹੈਗੀ ਹੈ ਪੰਜਾਬ ਦੀ ਇਹਨਾਂ ਸਾਰੀ ਮਤਲਬ ਇਹ ਸਾਰੀਆਂ ਚੀਜ਼ਾਂ ਹੁਣ ਆਉਣ ਵਾਲੇ ਟਾਈਮ 'ਚ ਨਾ ਸਾਡੇ ਟਾਈਮ 'ਚ ਬਹੁਤ ਬਹੁਤ ਕੁਛ ਸੀਗਾ ਹਿਸਟਰੀ 'ਚ ਨਾ ਅਤੇ ਹੁਣ ਤਾਂ ਸਭ ਕੁਛ ਅਲੋਪ ਹੀ ਹੋ ਗਿਆ ਮੇਰਾ ਛੋਟਾ ਭਰਾ ਹੈ ਉਹਨੂੰ ਪਤਾ ਹੀ ਨਹੀਂ ਹੈ ਹਿਸ ਹਿਸਟਰੀ ਉਹਨੇ ਪੜ੍ਹੀ ਹੀ ਨਹੀਂ ਹੈ ਕਿ ਪ ਸਿੱਖੀ ਕੀ ਹੈ ਪੰਜਾਬੀਅਤ ਕੀ ਹੈ ਉਹਨੂੰ ਪਤਾ ਹੀ ਨਹੀਂ ਹੈ ਪੰਜਾਬੀਅਤ ਦਾ ਔਰ ਪਿੰਡਾਂ 'ਚ ਤਾਂ ਅਜੇ ਫਿਰ ਵੀ ਚਲੋ ਪੰਜਾਬੀ ਹੈਗੀ ਹੈ ਮਤਲਬ ਸ਼ਹਿਰਾਂ 'ਚ ਤਾਂ ਬਿਲਕੁਲ ਹੀ ਅਲੋਪ ਹੋ ਗਈ ਹੈ ਪੰਜਾਬੀ ਨਾ ਈਵਨ ਕਿ ਸਾਡੇ ਖੁਦ ਦੇ ਬੱਚੇ ਪੰਜਾਬੀ ਬੋਲਣਾ ਪਸੰਦ ਨਹੀਂ ਕਰਦੇ ਸਕੂਲ ਜਾਉ ਤਾਂ ਕਨਫਿਊਜ਼ ਹੋ ਜਾਂਦੇ ਉੱਥੇ ਹਿੰਦੀ ਬੋਲਣੀ ਹੁੰਦੀ ਹੈ ਤਾਂ ਬੱਚੇ ਮਜ਼ਾਕ ਉਡਾਉਂਦੇ ਹੈ ਕਿ ਹਿੰਦੀ ਪੰਜਾਬੀ ਮਿਕਸ ਹੋ ਜਾਂਦੀ ਹੈ ਮਤਲਬ ਪੰਜਾਬੀ ਨੂੰ ਵਧਾਉਣ ਲਈ ਮੇਰੇ ਅਕੋਡਿੰਗ ਤਾਂ ਘਰ ਤੋਂ ਹੀ ਸਾਨੂੰ ਪੰਜਾਬੀ ਨੂੰ ਮਤਲਬ ਅੱਗੇ ਵਧਾਉਣ ਲਈ ਘਰ ਹੀ ਬੈਸਟ ਚੀਜ਼ ਹੈ ਪੇਰੈਂਟਸ ਜੋ ਹੈ ਮਾਹੌਲ ਘਰ ਦਾ ਅਤੇ ਇਸ ਨੂੰ ਸੁਰੱਖਿਅਤ ਕਿਵੇਂ ਰੱਖਿਆ ਸਕਦਾ ਸੁਰੱਖਿਅਤ ਰੱਖਣ ਲਈ ਉਹੀ ਹੈ ਕਿ ਮਤਲਬ ਸਾਡੀਆਂ ਸਰਕਾਰਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪੰਜਾਬੀ ਨੂੰ ਹਰ ਸਕੂਲ 'ਚ ਹਰ ਜਗ੍ਹਾ ਚਾਹੇ ਉਹ ਗਵਮੈਂਟ ਜੋਬਸ ਨੇ ਜਿੱਥੇ ਵੀ ਹੈ ਮਤਲਬ ਉਹਨੂੰ ਕੰਪਲਸਰੀ ਕਰਿਆ ਜਾਣਾ ਚਾਹੀਦਾ ਬੋਲਣਾ ਅਤੇ ਜਿਵੇਂ ਕਿ ਹੁਣ ਪੰਜਾਬ ਸਰਕਾਰ ਬੋਰਡ ਲਗਾ ਰਹੀ ਹੈ ਸਕੂਲਾਂ ਅੱਗੇ ਪੰਜਾਬੀ 'ਚ ਹਰ ਦਫਤਰਾਂ ਅੱਗੇ ਮਤਲਬ ਬੈਸਟ ਵੇਅ ਹੈਗਾ ਇਹਨੂੰ ਅੱਗੇ ਮਤਲਵ ਇਹਨੂੰ ਸੁਰੱਖਿਅਤ ਰੱਖਣ ਦਾ